ਹਾਂਜੀ ਮੈਂ ਸਿਮਰਨ ਗੱਲ ਕਰ ਰਹੀ ਹਾਂ ਮੈਂ ਵੈਸੇ ਤੇ ਗੁਰਦਾਸਪੁਰ ਤੋਂ ਬਿਲੋਂਗ ਕਰਦੀ ਹਾਂ ਪਰ ਮੈਂ ਇਸ ਵਕਤ ਸ਼ਹਿਰ ਤੋਂ ਬਾਹਰ ਆਈ ਹਾਂ ਹਾਂਜੀ ਮੈਂ ਰੀਚਾਰਜ ਕਰਵਾਉਣਾ ਚਾਹੁੰਦੀ ਹਾਂ ਆਪਣਾ ਅਤੇ ਮੇਰੇ ਕੋਲ ਨੈੱਟ ਬੈਂਕਿੰਗ ਨਹੀਂ ਆ ਅਤੇ ਮੈਂ ਦੁਕਾਨ 'ਤੇ ਜਾ ਰਹੀ ਹਾਂ ਹਾਂਜੀ ਮੈਂ ਆਪਣਾ ਰੀਚਾਰਜ ਕਰਵਾਉਣਾ ਸੀਗਾ ਕਿਉਂਕਿ ਮੇਰਾ ਰੀਚਾਰਜ ਖ਼ਤਮ ਆ ਅਤੇ ਮੇਰਾ ਜਿਹੜਾ ਮੋਬਾਇਲ ਨੰਬਰ ਆ ਉਹ ਹੈਗਾ ਵਾ ਸਤਾਨਵੇਂ ਅੱਠ ਸਤਾਰਾਂ ਸਤਾਰਾਂ ਤਿੰਨ ਬਾਈ ਏਰਟਲ ਕੰਪਨੀ ਦਾ ਆ ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਰੀਚਾਰਜ ਅਵੇਲੇਬਲ ਨੇ ਇਸ ਵਕਤ ਅਤੇ ਕਿਸ ਦੇ ਵਿੱਚ ਜ਼ਿਆਦਾ ਬੈਨੀਫਿਟ ਆ ਇੱਕ ਮਹੀਨੇ ਦਾ ਕਰਵਾਉਣ 'ਚ ਜਾਂ ਤਿੰਨ ਮਹੀਨੇ ਦਾ ਜਾਂ ਛੇ ਮਹੀਨੇ ਦਾ ਮੈਨੂੰ ਦੱਸਿਓ ਅਤੇ ਜਿਹੜਾ ਚਲੋ ਅ ਤੁਸੀਂ ਤਿੰਨ ਮਹੀਨੇ ਦਾ ਕਰ ਦਿਓ ਅਤੇ ਤਿੰਨ ਮਹੀਨੇ ਦਾ ਜਿਹੜਾ ਵਾ ਉਹ ਰੀਚਾਰਜ ਕਰ ਦਿਓ ਅਤੇ ਮੇਰੇ ਕੋਲ ਇਸ ਵਕਤ ਕੈਸ਼ ਨਹੀਂ ਹੈਗਾ ਅਤੇ ਮੈਂ ਤੁਸੀਂ ਮੇਰਾ ਰੀਚਾਰਜ ਕਰੋ ਅਤੇ ਮੈਂ ਆਪਣੇ ਰੀਚਾਰਜ ਹੁੰਦਿਆਂ ਬਾਅਦ ਫਿਰ ਮੈਂ ਆਪਣਾ ਗੂਗਲ ਪੇ ਕਰ ਦਿੰਦੀ ਹਾਂ ਤੁਹਾਨੂੰ ਪੈਸੇ ਕਿਉਂਕਿ ਮੇਰੇ ਕੋਲ ਕੈਸ਼ ਹੈ ਨਹੀਂ ਆ ਅਤੇ ਮੇਰਾ ਮੋਬਾਈਲ ਦੀ ਵੈਲਿਡਿਟੀ ਵੀ ਖ਼ਤਮ ਆ ਇਸ ਕਰਕੇ ਮੈਂ ਵੈਲਡਿਟੀ ਨਾ ਹੋਣ ਕਰਕੇ ਮੈਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਵੀ ਫੋਨ ਨਹੀਂ ਕਰ ਪਾ ਰਹੀ ਅਤੇ ਨਾ ਮੈਂ ਫੋਨ ਸੁਣ ਪਾ ਰਹੀ ਹਾਂ ਅਤੇ ਇਸ ਕਰਕੇ ਤੁਸੀਂ ਮੇਰਾ ਰੀਚਾਰਜ ਕਰ ਦਿਓ ਅਤੇ ਜਦੋਂ ਰੀਚਾਰਜ ਹੋ ਜਾਏਗਾ ਅਤੇ ਮੈਂ ਫਿਰ ਤੁਹਾਨੂੰ ਗੂਗਲ ਪੇ ਕਰ ਦਾਂਗੀ ਅਤੇ ਜਿੰਨੇ ਵੀ ਪੈਸੇ ਹੋਣਗੇ ਕਿਉਂਕਿ ਨੇਟ ਨਾ ਚੱਲਣ ਕਰਕੇ ਇੱਦਾਂ ਗੂਗਲ ਪੇ ਵੀ ਨਹੀਂ ਹੋ ਸਕਦਾ ਅਤੇ ਕੈਸ਼ ਮੇਰੇ ਕੋਲ ਵੈਸੇ ਹੈ ਨਹੀਂ ਆ ਸੋ ਮੇਰਾ ਮੇਰੇ ਪਰਿਵਾਰ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਆ ਮੇਰਾ ਮੇਰੇ ਬੱਚਿਆਂ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਆ ਅਤੇ ਇਸ ਲਈ ਕਿਰਪਾ ਕਰਕੇ ਤੁਸੀਂ ਮੇਰਾ ਰੀਚਾਰਜ ਕਰ ਦਿਓ ਅਤੇ ਮੈਂ ਤੁਹਾਡਾ ਪੇ ਕਰ ਦਿੰਦੀ ਆ ਨੈਟ ਚੱਲਣ ਤੋਂ ਬਾਅਦ